ਕਿਤਾਬਾਂ ਸਾਡੀ ਜ਼ਿੰਦਗੀ ਦਾ ਅਹਿਮ ਹੰਗ ਅੰਗ ਹਨ ਕਿਤਾਬਾਂ ਹਰ ਇੱਕ ਨੂੰ ਆਪਣੇ ਆਪਣੇ ਅਨੁਸਾਰ ਕਿਤਾਬ ਪਸੰਦ ਹੁੰਦੀਆਂ ਹਨ ਕੋਈ ਨਾਵਲ ਪੜ੍ਹਨ ਦਾ ਸ਼ੌਕੀਨ ਹੁੰਦਾ ਹੈ ਕੋਈ ਕਵਿਤਾਵਾਂ ਪੜ੍ਹ ਕੇ ਆਨੰਦ ਲੈਂਦਾ ਹੈ ਅਤੇ ਕੋਈ ਕਹਾਣੀਆ ਪੜ੍ਹ ਕੇ ਆਨੰਦ ਲੈਂਦਾ ਹੈ ਕੋਈ ਇਤਿਹਾਸ ਵਾਲੀਆਂ ਕਿਤਾਬਾਂ ਪੜ੍ਹਦਾ ਹੈ ਪਰ ਮੈਨੂੰ ਸਭ ਤੋਂ ਜਿਹੜੀਆਂ ਕ ਵਧੀਆ ਲੱਗਦੀ ਹੈ ਕਿਤਾ ਕਿਤਾਬ ਪੜ੍ਹਨੀਆਂ ਉਹਦੇ ਵਿੱਚ ਨਾਵਲ ਅਤੇ ਕਹਾਣੀਆਂ ਨੇ ਜਿਵੇਂ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਹਨ ਕਿਉਂਕਿ ਉਹ ਨਿਕ ਨਿੱਕੀਆਂ ਕਹਾਣੀਆਂ ਦਾ ਵੱਡਾ ਵੱਡਾ ਲਿਖਾਰੀ ਹੈ ਉਹਦੀਆਂ ਕਹਾਣੀਆਂ ਵਿੱਚ ਸਾਡੇ ਪੰਜਾਬੀ ਪੰਜਾਬੀਅਤ ਨੂੰ ਦਿਖਾ ਦਰਸਾਇਆ ਗਿਆ ਹੈ ਇਸ ਤਰ੍ਹਾਂ ਹੀ ਮੈਨੂੰ ਦਲੀਪ ਕੌਰ ਟਿਵਾਣਾ ਦੀਆਂ ਜਿਹੜੀਆਂ ਕਹਾਣੀਆਂ ਨਾਵਲ ਨੇ ਉਹ ਬਹੁਤ ਵਧੀਆ ਲੱਗਦੇ ਨੇ ਕਿਉਂਕਿ ਦਲੀਪ ਕੌਰ ਟਿਵਾਣਾ ਹਮੇਸ਼ਾ ਹੀ ਔਰਤ ਦੀ ਹਾਲਤ ਦੀ ਗੱਲ ਕਰਦੇ ਉਸ ਵਿੱਚ ਸੁਧਾਰ ਕਰਨ ਦੀ ਗੱਲ ਕਰਦੀ ਹੈ ਔਰਤ ਦੀ ਅਸਲੀ ਦਿਸ਼ਾ ਨੂੰ ਉਹ ਦ ਦਰਸਾਉਂਦੀ ਹੈ ਇਸ ਤਰ੍ਹਾਂ ਸਾਡੇ ਕੋਲ ਨਾਨਕ ਸਿੰਘ ਦੀਆਂ ਕਹਾਣੀਆਂ ਨੇ ਜਿਹਦੇ ਵਿੱਚ ਕੁਛ ਇਤਿਹਾਸਿਕ ਗੱਲਾਂ ਨੂੰ ਲਿਆ ਗਿਆ ਹੈ ਇਸ ਤਰ੍ਹਾਂ ਹੀ ਅੰਮ੍ਰਿਤਾ ਪ੍ਰੀਤਮ ਦੀਆਂ ਕਹਾਣੀਆਂ ਨੇ ਔਰ ਸੁਰਜੀਤ ਪਾਤਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਹਨ ਜਿਹੜੀਆਂ ਕਿ ਬਹੁਤ ਹੀ ਵਧੀਆ ਹਨ ਅਤੇ ਜਿਹੜੀ ਆਪਣੇ ਪੰਜਾ ਹ ਇਸ ਤਰ੍ਹਾਂ ਪੂਰਨ ਸਿੰਘ ਨੂੰ ਨਿੱਕੀਆਂ ਕਹਾਣੀਆਂ ਦਾ ਨਿੱਕੀਆਂ ਕਵਿਤਾਵਾਂ ਦਾ ਕਵੀ ਵੀ ਕਿਹਾ ਜਾਂਦਾ ਹੈ ਇਸ ਨੇ ਵੀ ਸ ਪੰਜਾਬ ਪੰਜਾਬ ਔਰ ਪੰਜਾਬੀਅਤ ਬਾਰੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਹਨ